ਮੋਹਾਲੀ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਬਾਕੀ ਡਿਸਟਰਾਂ ਦੇ ਮੁਕਾਬਲੇ ਬਹੁਤ ਵਧੀਆ ਹਨ ਕਿਉਂਕਿ ਇਹ ਜਿਹੜਾ ਮੋਹਾਲੀ ਡਿਸਟ੍ਰਿਕਟ ਹੈਗਾ ਇਹ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਇੱਥੇ ਆਪਾਂ ਨੂੰ ਵਧੀਆ ਡੋਕਟਰ ਚੰਗੀ ਸਿਹਤ ਸੇਵਾਵਾਂ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਮਿਲ ਜਾਂਦੀਆਂ ਹਨ ਕਿਉਂਕਿ ਹਰੇਕ ਡਾਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉਸਦੀ ਜਿਹੜੀ ਰਿਹਾਇਸ਼ ਹੈਗੀ ਹੈ ਉਹ ਵਧੀਆ ਜਗ੍ਹਾ 'ਤੇ ਹੋਵੇ ਮੋਹਾਲੀ ਜਿਹੜਾ ਹੈਗਾ ਉਹ ਟ੍ਰਾਈ ਸਿਟੀ ਦੇ ਵਿੱਚ ਹੈ ਇਸ ਕਰਕੇ ਇੱਥੇ ਹਰ ਪ੍ਰਕਾਰ ਦੀ ਸਾ ਜਿਹੜੀ ਮੈਡੀਕਲ ਫੈਸਿਲਿਟੀ ਹੈਗੀ ਹੈ ਉਹ ਮਿਲ ਜਾਂਦੀ ਹੈਗੀ ਹੈ ਅਤੇ ਹਸਪਤਾਲ ਵੀ ਜਿਹੜੇ ਪ੍ਰਾਈਵੇਟ ਹੈਗੇ ਹੈ ਫੋਰਟਿਸ ਹਸਪਤਾਲ ਆ ਗਏ ਜਾਂ ਹੋਰ ਇਸ ਤਰੀਕੇ ਦੇ ਕਈ ਹਸਪਤਾਲ ਹਨ ਜਿਨ੍ਹਾਂ ਦੇ ਵਿੱਚ ਕਿ ਬਹੁਤ ਹੀ ਵਧੀਆ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਆਪਣੇ ਕੋਲ ਉਪਲਬਧ ਹਨ ਕੋਵਿਡ ਮਹਾਂ ਮ ਦੌਰਾਨ ਦੇਖਿਆ ਗਿਆ ਕਿ ਹਸਪਤਾਲਾਂ ਦੇ ਵਿੱਚ ਐਨਾ ਵਧੀਆ ਅਰੇਜਮੈਂਟ ਨਹੀਂ ਸੀ ਕਈਆਂ ਦੇ ਵਿੱਚ ਵੈਂਟੀਲੇਟਰ ਨਹੀਂ ਸਨ ਕਈਆਂ ਦੇ ਵਿੱਚ ਜੇ ਵੈਂਟੀਲੇਟਰ ਹਨ ਸਨ ਤਾਂ ਉਹ ਕੰਮ ਨਹੀਂ ਕਰ ਰਹੇ ਸਨ ਇਸ ਕਰਕੇ ਕੋਵਿਡ ਮਹਾਂਮਾਰੀ ਨੇ ਸਾਨੂੰ ਇੱਕ ਬੜੀ ਵਧੀਆ ਸਿੱਖਿਆ ਦਿੱਤੀ ਹੈ ਕਿ ਸਾਨੂੰ ਹਰ ਟਾਈਮ ਕੋਈ ਅਜਿਹੀ ਮਹਾਂਮਾਰੀ ਆਵੇ ਤਾਂ ਸਾਨੂੰ ਉਸ ਦੇ ਨਜਿੱਠਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਜਿਹੜੀ ਹੈਗੀ ਹੈ ਜਾਨ ਵੱਧ ਤੋਂ ਵੱਧ ਬੱਚ ਸਕੇ ਥੈਂਕ ਯੂ